ਸਤਿ ਸ਼੍ਰੀ ਅਕਾਲ ਜੀ ਅਸੀਂ ਇਕ ਆਟੋ ਬੁੱਕ ਕੀਤਾ ਸੀ ਤੁਹਾਡਾ ਤੇ ਤੁਸੀਂ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਕਿ ਅਸੀਂ ਆ ਜਾਂਗੇ ਅੱਧੇ ਘੰਟੇ ਦੇ ਵਿੱਚ ਤੇ ਸਾਨੂੰ ਵੇਟ ਕਰਦਿਆਂ ਨੂੰ ਦੋ ਘੰਟੇ ਹੋ ਗਏ ਹਾਲੇ ਤਿਕਰ ਤੁਸੀਂ ਆਏ ਨੀ ਤੁਸੀਂ ਕਿੱਥੇ ਰਹਿੰਦੇ ਹੋ ਕਿਹੜੇ ਰੋਡ ਤੇ ਰਹਿੰਦੇ ਹੋ ਤੁਸੀਂ ਤੇ ਤੁਸੀਂ ਹਾਲੇ ਤੀਕਰ ਸਾਡੇ ਕੋਲ ਪਹੁੰਚੇ ਨੀ ਸਾਨੂੰ ਵੇਟ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਅਸੀਂ ਜਲਦੀ ਜਲਦੀ ਪਹੁੰਚਣਾ ਸੀ ਕਿਤੇ ਤੇ ਹਲੇ ਤਿਕਰ ਤੁਹਾਡੀ ਵੇਟ ਹੀ ਕਰ ਰਹੇ ਆਂ ਤੁਸੀਂ ਸਾਨੂੰ ਲੇਟ ਕਰਾ ਤਾ ਇਨਾ ਜੇਕਰ ਨਹੀਂ ਆਉਣਾ ਸੀ ਤਾਂ ਸਾਨੂੰ ਪਹਿਲਾਂ ਹੀ ਦੱਸਿਆ ਜਾਂਦਾ ਵੀ ਅਸੀਂ ਨਹੀਂ ਆ ਸਕਦਾ ਪਰ ਹਾਲੇ ਤਿਕਰ ਤੁਸੀਂ ਆਏ ਹੀ ਨਹੀਂ ਪਰ ਤੁਸੀਂ ਰਹਿੰਦੇ ਕਿੱਥੇ ਹੋ ਕਿਹੜੇ ਰੋਡ 'ਤੇ ਰਹਿਨੇ ਹੋ ਪਲੀਜ਼ ਸਾਨੂੰ ਦੱਸੋ ਹਲੇ ਤੀਕਰ ਆਏ ਕਿਉਂ ਨਹੀਂ ਤੁਸੀਂ ਹਾਂਜੀ